ਭਾਰਤ ਵਿੱਚ ਕਈ ਥਾਵਾਂ ਇਹੋ ਜਿਹੀਆਂ ਹਨ ਜਿਨ੍ਹਾਂ ਨੂੰ ਮੈਂ ਜ਼ਰੂਰ ਦੇਖਣਾ ਚਾਹਾਂਗੀ ਪਰ ਸਾਈਕਲ 'ਤੇ ਜਾਣਾ ਮੈਨੂੰ ਨਹੀਂ ਲੱਗਦਾ ਕਿ ਮੈਂ ਇੰਨੀ ਦੂਰ ਤੱਕ ਸਾਈਕਲ 'ਤੇ ਜਾ ਸਕਦੀ ਹਾਂ ਜਾਂ ਮੈਨੂੰ ਇਸ ਚੀਜ਼ ਦਾ ਇੰਨਾ ਜ਼ਿਆਦਾ ਕੋਈ ਕਰੇਜ਼ ਨਹੀਂ ਹੈਗਾ ਠੀਕ ਹੈ ਮੈਂ ਥੋੜ੍ਹੀ ਦੂਰੀ ਤੱਕ ਸਾਈਕਲ ਲੈ ਕੇ ਜਾ ਸਕਦੀ ਹਾਂ ਪਰ ਜ਼ਿਆਦਾ ਦੂਰੀ ਤੱਕ ਮੈਂ ਨਹੀਂ ਲੈ ਕੇ ਜਾ ਸਕਦੀ